ਭਾਰਤ ਵਿੱਚ ਬਹੁਤ ਸਾਰੀਆਂ ਨਾਚ ਸ਼ੈਲੀਆਂ ਪਾਈਆਂ ਜਾਂਦੀਆਂ ਹਨ ਇਹ ਸਾਡੀ ਪਰੰਪਰਾ ਨਾਲ ਜੁੜੀਆਂ ਹੋਈਆਂ ਹਨ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵੱਖ ਵੱਖ ਨਾਚ ਮਸ਼ਹੂਰ ਹਨ ਜੋ ਸਥਾਨਕ ਲੋਕਾਂ ਦਾ ਮਨੋਰੰਜਨ ਕਰਦੇ ਹਨ ਇਨ੍ਹਾਂ ਵਿੱਚੋਂ ਮੈਂ ਜੋ ਕੋਚੀ ਪੂੜੀ ਜੋ ਆਂਧਰਾ ਪ੍ਰਦੇਸ਼ ਦਾ ਪ੍ਰਸਿੱਧ ਨਾਚ ਹੈ ਬਾਰੇ ਜਾਣਦੀ ਹਾਂ ਇਹ ਪੂਰੇ ਦੱਖਣੀ ਭਾਰਤ ਵਿੱਚ ਮਸ਼ਹੂਰ ਹੈ ਇਸ ਦਾ ਸਬੰਧ ਕ੍ਰਿਸ਼ਨ ਨਾਲ ਜੋੜਿਆ ਜਾਂਦਾ ਹੈ ਇਹ ਸਿਰਫ ਅਤੇ ਸਿਰਫ ਮਰਦਾਂ ਦਾ ਨਾਚ ਹੈ ਇਸ ਦੇ ਨਾਲ ਮੈਂ ਪੰਜਾਬ ਦੇ ਲੋਕ ਨਾਚਾਂ ਦੀ ਗੱਲ ਕਰਾਂ ਤਾਂ ਪੰਜਾਬ ਦੇ ਲੋਕ ਨਾਚਾਂ ਵਿੱਚੋਂ ਮੈਂ ਗਿੱਧੇ ਭੰਗੜੇ ਬਾਰੇ ਜਾਣਦੀ ਹਾਂ ਭੰਗੜਾ ਮਰਦਾਂ ਦੁਆਰਾ ਪਾਇਆ ਜਾਂਦਾ ਹੈ ਅਤੇ ਗਿੱਧਾ ਔਰਤਾਂ ਦੁਆਰਾ ਪਾਇਆ ਜਾਂਦਾ ਹੈ ਇਸ ਦੇ ਨਾਲ ਨਾਲ ਪ੍ਰਸਿੱਧ ਲੋਕ ਨਾਚ ਹਨ ਲੁੱਡੀ ਸੰਮੀ ਅਤੇ ਗਿੱਧਾ ਇਸ ਦੇ ਨਾਲ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਝੂਮਰ ਵੀ ਹਨ ਜੋ ਕਿ ਮਰਦਾਂ ਦੁਆਰਾ ਪਾਇਆ ਜਾਂਦਾ ਹੈ ਜੇ ਮੈਂ ਮਸ਼ਹੂਰ ਡਾਂਸਰ ਦੀ ਗੱਲ ਕਰਾਂ ਤਾਂ ਡਾਂਸਰ ਲਕਸ਼ਮੀ ਨਾਰਾਇਣ ਸ਼ਾਸ਼ਤਰੀ ਨੂੰ ਮੈਂ ਜਾਣਦੀ ਹਾਂ